ਸਾਡੀ ਰਸੋਈ ਵਿੱਚ ਆਮ ਤੌਰ 'ਤੇ ਜਿਵੇਂ ਕਿ ਬਿਜਲੀ ਵਾਲੇ ਉਪਕਰਨ ਹਨ ਗਰੈਂਡਰ ਮਿਕਸੀ ਫਰਿਜ ਗੀਜ਼ਰ ਟੋਸਟਡ ਇਲੈਕਟਸਨੋਨ ਇਲੈਕਟਰੋਨਿਸ ਚੁੱਲ੍ਹਾ ਅਤੇ ਅਡਸਟਫੈਨ ਇਹ ਆਮ ਤੌਰ 'ਤੇ ਬਿਜਲੀ ਦੇ ਸੰਚਾਲਕ ਸਾਡੇ ਰਸੋਈ ਘਰ ਦੇ ਵਿੱਚ ਆਮ ਤੌਰ 'ਤੇ ਉਪਲੱਬਧ ਹਨ ਇਹ ਉਪਕਰਨ ਆਮ ਤੌਰ 'ਤੇ ਸਾਡੇ ਨਿੱਜੀ ਜੀਵਨ ਵਿੱਚ ਰੋਜ਼ਾਨਾ ਜੀਵਨ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਹਨ